ਹੈਲੋ ਮੈਂ ਸੁਣਿਆ ਕਿ ਤੇਰਾ ਪੀ ਐਮ ਕੇ ਵੀ ਦੇ ਵਿੱਚ ਦਾਖਲਾ ਹੋ ਗਿਆ ਹੈ ਮੇ ਮੈਂ ਵੀ ਉੱਥੇ ਗਿਆ ਸੀ ਪਰ ਮੈਂ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ ਮੈਂ ਸੁਣਿਆ ਸੀ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਇਹਦੇ ਵਿੱਚ ਦਾਖਲਾ ਮਿਲ ਰਿਹਾ ਹੈ ਇਸ ਕਰਕੇ ਮੈਨੂੰ ਵੀ ਦੱਸ ਦੇ ਕਿ ਤੂੰ ਕਿਵੇਂ ਦਾਖਲਾ ਲਿਆ ਅਤੇ ਕੀ ਕੀ ਡਾਕੂਮੈਂਟ ਚਾਹੀਦੇ ਹਨ ਮੈਨੂੰ ਵੀ ਦੱਸ ਦੇ ਮੈਂ ਵੀ ਅੱਗੇ ਤੋਂ ਤਿਆਰੀ ਰੱਖੂੰਗਾ ਕਿਵੇਂ ਕੀ ਕੁਝ ਕਰਨਾ ਹੈ ਤੂੰ ਮੈਨੂੰ ਸਾਰਾ ਕੁਝ ਲਿਖ ਕੇ ਮੇਰੇ ਵਟਸਐਪ 'ਤੇ ਭੇਜ ਦੇ ਮੈਂ ਸੁਣ ਮੈਂ ਵੀ ਇਸ ਦੇ ਵਿੱਚ ਪੂਰਾ ਇੰਟਰਸਟ ਰੱਖਦਾ ਹਾਂ ਮੈਨੂੰ ਬਹੁਤ ਪਸੰਦ ਹੈ ਪੀ ਐਮ ਕੇ ਵੀ ਕੋਰਸ ਮੇਰਾ ਇਸ ਦੇ ਵਿੱਚ ਨੰਬਰ ਨਹੀਂ ਆਇਆ ਮੈਂ ਬਹੁਤ ਦੁਖੀ ਹੋਇਆ ਇਸ ਦੇ ਨਾਲ ਮੇਰਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ ਮੈਨੂੰ ਫਿਰ ਮੈਂ ਸੁਣਿਆ ਮੇਰੇ ਮਿੱਤਰ ਦਾ ਇੱਕ ਨਾਮ ਆਇਆ ਤੇਰਾ ਇਸ ਕਰਕੇ ਮੈਨੂੰ ਦੱਸ ਦੇ ਕਿ ਕੀ ਕੀ ਚਾਹੀਦਾ ਹੈ ਡਾਕੂਮੈਂਟਸ ਮੈਂ ਉਹ ਡਾਕੂਮੈਂਟਸ ਤੇਰੇ ਕੋਲ ਲੈ ਆਉਂਗਾ ਅਤੇ ਮੈਨੂੰ ਦੱਸ ਦੀਂ ਕੀ ਕੀ ਕੁਛ ਚਾਹੀਦਾ ਹੁੰਦਾ ਹੈ ਠੀਕ ਹੈ ਤੂੰ ਵੀ ਬਹੁਤ ਵਧੀਆ ਕੋਰਸ ਜੁਆਇਨ ਕੀਤਾ ਹੈ ਮੈਨੂੰ ਨਹੀਂ ਪਤਾ ਸੀ ਕਿ ਤੈਨੂੰ ਵੀ ਪੀ ਐਮ ਕੇ ਵੀ ਕੋਰਸ ਪਸੰਦ ਹੈ ਇਹ ਕੋਰਸ ਤਾਂ ਬਹੁਤ ਚੰਗਾ ਹੈ ਇੱਕ ਵਾਰ ਮੈਨੂੰ ਵੀ ਇਹਦੇ ਵਿੱਚ ਸਲਾਹ ਦੇ ਦੇ ਕੀ ਕਰਨਾ ਹੈ ਮੈਂ ਵੀ ਇਸ ਦੀ ਬਹੁਤ ਪੜ੍ਹਾਈ ਕਰਦਾ ਹਾਂ ਤੂੰ ਤੂੰ ਪਾਸ ਹੋ ਗਿਆ ਹੈ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਰਹਿ ਗਿਆ ਕੋਈ ਨਹੀਂ ਮੇਰਾ ਹੋ ਜੂਗਾ ਇੱਕ ਵਾਰ ਮੈਨੂੰ ਵੀ ਨੋਟਸ ਆਪਣੇ ਦੇ ਦੀ ਕਿ ਮੈਂ ਪਾਸ ਹੋ ਕੇ ਤੇਰੇ ਨਾਲ ਹੀ ਇਹ ਕੋਰਸ 'ਚ ਦਾਖਲਾ ਹੋ ਲਵਾਂ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੇਰਾ ਦਾਖਲਾ ਹੋ ਗਿਆ ਹੈ ਇਸ ਕਰਕੇ ਮੈਂ ਤੇਰੇ ਕੋਲ ਪਾਰਟੀ ਲੈਣ ਆਵਾਂਗਾ ਮੈਂ ਵੀ ਇਸ ਦੇ ਨਾਲ ਕੋਰਸ ਕੰਪਲੀਟ ਕਰਕੇ ਤੇਰੇ ਨਾਲ ਜਲਦ ਹੀ ਜੋਇਨਿੰਗ ਸਟਾਰਟ ਕਰਾਂਗਾ